ਹ ਹਾਂ ਮੈਂ ਫੋਟੋਗ੍ਰਾਫੀ ਨੂੰ ਇੱਕ ਪੇਸ਼ੇ ਵਜੋਂ ਲੈਣ ਬਾਰੇ ਸੋਚਿਆ ਸੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਪੈਸੇ ਅਸੀਂ ਕਮਾ ਸਕਦੇ ਹਾਂ ਇਸ ਨਾਲ ਸਰਕਾਰੀ ਨੌਕਰੀਆਂ ਨਿਕਲਦੀਆਂ ਜਿੱਥੇ ਕਿ ਫੋਟੋਗ੍ਰਾਫੀ ਦੀ ਨੌਕਰੀ ਹੁੰਦੀ ਹੈ ਜਿਵੇਂ ਕਿ ਸੀ ਆਈ ਡੀ ਵਗੈਰਾ ਹੋ ਗਿਆ ਉੱਥੇ ਅਸੀਂ ਫੋਟੋਆਂ ਕਰ ਸਕਦੇ ਹਾਂ ਵੀ ਜਿੱਥੇ ਵੀ ਕੋਈ ਕ੍ਰਾਈਮ ਹੋਇਆ ਹੋਵੇ ਉੱਥੇ ਉਹਨਾਂ ਨੂੰ ਇੱਕ ਫੋਟੋਗ੍ਰਾਫਰ ਚਾਹੀਦਾ ਹੁੰਦਾ ਹੈ ਜੋ ਕਿ ਨਾਲ ਦੀ ਨਾਲ ਫੋਟੋ ਖਿੱਚ ਸਕਦਾ ਇਸ ਲਈ ਮੈਂ ਵੀ ਸੋਚਿਆ ਸੀ ਕਿਉਂਕਿ ਮੈਂ ਵੱਧ ਤੋਂ ਵੱਧ ਪੈਸੇ ਕਮਾਉਣਾ ਚਾਹੁੰਦੀ ਹਾਂ ਅਤੇ ਅਸੀਂ ਫੋਟੋਗ੍ਰਾਫੀ ਵਿੱਚ ਵੱਧ ਤੋਂ ਵੱਧ ਪੈਸੇ ਕਮਾ ਸਕਦੇ ਹਾਂ ਇਸ ਲਈ ਮੈਂ ਇਹ ਪੇਸ਼ਾ ਲੈਣ ਬਾਰੇ ਸੋਚਿਆ ਸੀ ਜਿਵੇਂ ਕਿ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਵਿਆਹ ਵਿੱਚ ਫੋਟੋਗ੍ਰਾਫੀ ਬਹੁਤ ਜ਼ਿਆਦਾ ਟਰੈਂਡ ਵਿੱਚ ਹੈ ਲੋਕ ਮਤਲਬ ਵੱਖ ਵੱਖ ਫੋਟੋਗ੍ਰਾਫਰਾਂ ਨੂੰ ਬੁਲਾਉਂਦੇ ਆ ਫੋਟੋ ਕਰਨ ਲਈ ਪ੍ਰੀ ਵੈਡਿੰਗ ਸ਼ੂਟ ਲਈ ਵੀ ਫੋਟੋਗ੍ਰਾਫ ਚਾਹੀਦਾ ਹੁੰਦਾ ਅਤੇ ਕੋਈ ਵੀ ਆਪਾਂ ਉਹ ਫੋਟੋ ਕਰਵਾਉਣੀ ਹੋਵੇ ਪਾਸਪੋਰਟ ਸਾਈਜ਼ ਲਈ ਤਾਂ ਉਹਦੇ ਵਿੱਚ ਵੀ ਫੋਟੋਗ੍ਰਾਫਰ ਦੀ ਜ਼ਰੂਰਤ ਪੈਂਦੀ ਹੈ ਅਤੇ ਫੋਟੋਗ੍ਰਾਫੀ ਨਾਲ ਅਸੀਂ ਵੱਧ ਤੋਂ ਵੱਧ ਪੈਸਾ ਕਮਾ ਸਕਦੇ ਹਾਂ ਇਸ ਲਈ ਲੋਕ ਜ਼ਿਆਦਾ ਤੋਂ ਜ਼ਿਆਦਾ ਇੱਧਰ ਜਾਂਦੇ ਨੇ ਅਤੇ ਇਹ ਕੰਮ ਵੀ ਲੋਕ ਸ਼ੌਂਕ ਵਜੋਂ ਕਰਦੇ ਆ ਕਿਉਂਕਿ ਕਈ ਲੋਕ ਫੋਨ 'ਤੇ ਫੋਟੋਆਂ ਖਿੱਚਦੇ ਆ ਪਹਿਲਾਂ ਅਤੇ ਉਸ ਤੋਂ ਬਾਅਦ ਇਹ ਕੈਮਰੇ ਰਾਹੀਂ ਫੋਟੋਗ੍ਰਾਫੀ ਕਰਨਾ ਚਾਹੁੰਦੇ ਆ ਜਿਹਦੇ ਨਾਲ ਕਿ ਲੋਕਾਂ ਨੂੰ ਵੱਧ ਤੋਂ ਵੱਧ ਪੈਸਾ ਮਿਲਦਾ ਅਤੇ ਉਹਨਾਂ ਦਾ ਜਿਹੜਾ ਕਿ ਫਿਊਚਰ ਆ ਉਹ ਸਿਕਿਓਰ ਹੋ ਜਾਂਦਾ ਅਤੇ ਉਹ ਵੱਧ ਤੋਂ ਵੱਧ ਪੈਸੇ ਕਮਾ ਕੇ ਆਪਣਾ ਫਿਊਚਰ ਜਿਹੜਾ ਕਿ ਹੈ ਸੇਫ ਕਰ ਲੈਂਦੇ ਆ